ਹੈਲੋ ਸਤਿ ਸ਼੍ਰੀ ਅਕਾਲ ਵਧੀਆ ਤੁਸੀਂ ਦੱਸੋ ਹੋਰ ਹਾਂਜੀ ਵਧੀਆ ਸਭ ਐਕਚੁਲੀ ਨਾ ਜਿਹੜੇ ਸਾਡੇ ਆਨੇਵਾਨ 'ਚ ਨਵੇਂ ਪੜੌਸੀ ਆਏ ਹੈ ਨਾ ਉਹਨਾਂ ਕਰਕੇ ਬਹੁਤ ਹੀ ਜ਼ਿਆਦਾ ਸ਼ੋਰ ਮੱਚ ਰਿਹਾ ਉਹਨਾਂ ਕਰਕੇ ਐਨਾ ਜ਼ਿਆਦਾ ਆਲੇ ਦੁਆਲੇ ਨੂੰ ਪਰੇਸ਼ਾਨੀ ਹੋ ਰਹੀ ਹੈ ਇਸ ਕਰਕੇ ਸਾਡੇ ਆਂਢ ਗੁਆਂਢ 'ਚ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਐਨਾ ਜ਼ਿਆਦਾ ਰੋਲਾ ਰੱਪਾ ਪੈ ਰਿਹਾ ਪੁੱਛੇ ਤੁਹਾਨੂੰ ਉਹਨਾ ਨੂੰ ਸਮਝਾਣਾ ਚਾਹੀਦਾ ਹੈ ਕਿ ਐਨਾ ਰੌਲਾ ਰੱਪਾ ਨਹੀਂ ਪਾਉਣਾ ਚਾਹੀਦਾ ਇੱਦਾਂ ਆਂਢ ਗੁਆਂਢ ਨੂੰ ਪਰੇਸ਼ਾਨੀ ਹੁੰਦੀ ਹੈ ਅਤੇ ਰੌਲਾ ਬਹੁਤ ਜ਼ਿਆਦਾ ਪੈਂਦਾ ਹੈ ਅਤੇ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਹਾਂਜੀ ਠੀਕ ਹੈ ਅਤੇ ਮੈਂ ਥੋੜੀ ਦੇਰ ਤੱਕ ਫ੍ਰੀ ਹਾਂ ਆਪਾਂ ਫੇਰ ਗੱਲ ਕਰਦੇ ਹਾਂ ਠੀਕ ਸਤਿ ਸ਼੍ਰੀ ਅਕਾਲ